ਗਤਕਾਂ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੱਦੀ ਏ ਦੇ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਇਹਨਾਂ ਸੇਲੀਆਂ ਵਿੱਚ ਹੀ ਇੱਕ ਸੇਲੀ ਹੈ ਗਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਇਲਾਕਿਆਂ ਵਿੱਚ ਪ੍ਰਚਲਿਤ ਹੈ ਮੁੱਖ ਰੂਪ ਵਿੱਚ ਦੋ ਪ੍ਰਤੱਖ ਨਿਪੁੰਨਤਾ ਹਾਸਿਲ ਕਰਨੀ ਜਰੂਰੀ ਹੈ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਦਾ ਹਮਲਾ ਰੋਕਣਾ ਅਤੇ ਦੂਜੇ ਵਿਰੋਧੀ ਤੇ ਹਮਲਾ ਕਰਨਾ ਗਤਕਾ ਖੇਡਣ ਲਈ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਹਨ ਹਮਲਾ ਕਰਨ ਲਈ ਗਤਕਾ ਸੋਟੀ ਜਾਂ ਤਲਵਾਰ ਅਤੇ ਹਮਲਾ ਰੋਕਣ ਲਈ ਢਾਲ ਹੁੰਦੀ ਹੈ ਗਤਕਾ ਇੱਕ ਇੱਕ ਮੀਟਰ ਦੀ ਕਰੀਬ ਲੰਬਾ ਡੰਡਾ ਹੁੰਦਾ ਹੈ ਇਸ ਦੇ ਇਸ ਦੇ ਇੱਕ ਸਿਰੇ ਤੇ ਹੱਥ ਦੇ ਚੰਗੀ ਪਕੜ ਦੀ ਸੁਰੱਖਿਆ ਲਈ ਇੱਕ ਗੱਦੀ ਲਗਾਈ ਹੁੰਦੀ ਹੈ ਸਸਤਰ ਵਿੱਦਿਆ ਦੇ ਖਜ਼ਾਨੇ ਬਾਬਾ ਬੁੱਢਾ ਜੀ ਨੇ ਸੰਭਾਲਿਆ ਤੀਜੇ ਗੁਰੂ ਅਮਰਦਾਸ ਜੀ ਨੇ ਧਿਆਨ ਸਿਮਰਨ ਨੂੰ ਮੁੱਖ ਰਖਿਆ ਤੇ ਮੱਲ ਅਖਾੜੇ ਮੱਲ ਅਖਾੜੇ ਦੀ ਵਿਸਥਾਰ ਵਿਰਾਸਤ ਸੰਭਾਲੀ ਇਹਨਾਂ ਸਿੱਖਾਂ ਦੇ ਪੰਜ ਪੰਜ ਕੰਕਾਰ ਕੜਾ ਕਛਹਿਰਾ ਕੇਸ ਕੜਾ ਕਛਹਿਰਾ ਕੇਸ ਕਿਰਪਾਨ ਅਤੇ ਕੇਸ ਹੁੰਦੇ ਹਨ ਅਤੇ ਸਿੱਖ ਨੀਲਾ ਬਾਣਾ ਪਹਿਣਦੇ ਹਨ ਜੋ ਕੀ ਉਹਨਾਂ ਦੇ ਧਾਰਮਿਕ